ਮੈਂ ਭਾਰਤ ਦੇਸ਼ ਦੇ ਪੰਜਾਬ ਰਾਜ ਦੇ ਮੁਕਤਸਰ ਦਾ ਰਹਿਣ ਵਾਲਾ ਹਾਂ ਜਿਸ ਵਿੱਚ ਬਹੁਤ ਸਾਰੇ ਧਰਮ ਪਾਏ ਜਾਂਦੇ ਹਨ ਜਿਸ ਵਿੱਚੋਂ ਮੁੱਖ ਧਰਮ ਸਿੱਖ ਅਤੇ ਹਿੰਦੂ ਹਨ ਬਾਕੀ ਇੱਥੇ ਇਸਾਈ ਧਰਮ ਅਤੇ ਮੁਸਲਿਮ ਧਰਮ ਦੇ ਲੋਕ ਵੀ ਬਹੁਤ ਪਾਏ ਜਾਂਦੇ ਹਨ ਪਰ ਉਹਨਾਂ ਦੀ ਗਿਣਤੀ ਇਹਨਾਂ ਦੋਵਾਂ ਦੇ ਮੁਕਾਬਲੇ ਘੱਟ ਹੈ ਮੈਂ ਖੁਦ ਸਿੱਖ ਧਰਮ ਤੋਂ ਬਿਲੋਂਗ ਕਰਦਾ ਹਾਂ ਜਿਸ ਕਰਕੇ ਮੈਨੂੰ ਸਿੱਖ ਧਰਮ ਅਤੇ ਹਿੰਦੂ ਧਰਮ ਦੀ ਥੋੜ੍ਹੀ ਬਹੁਤ ਜਾਣਕਾਰੀ ਹੈ ਜਿਸ ਕਰਕੇ ਮੈਂ ਤੁਹਾਨੂੰ ਆਪਣੇ ਧਰਮ ਬਾਰੇ ਦੱਸਣ ਜਾ ਰਿਹਾ ਹਾਂ ਸਿ ਮੈਂ ਆਪਣੇ ਦਾਦੀ ਜੀ ਜੋ ਕਿ ਸਿੱਖ ਧਰਮ ਤੋਂ ਹੀ ਬਿਲੋਂਗ ਕਰਦੇ ਹਨ ਬਾਰੇ ਦੱਸਣ ਜਾ ਰਿਹਾ ਹਾਂ ਉਹ ਸੁਬਾਹ ਉੱਠ ਕੇ ਨਹਾ ਧੋ ਕੇ ਅਤੇ ਅੰਮ੍ਰਿਤ ਵੇਲੇ ਉੱਠਦੇ ਹਨ ਜੋ ਕਿ ਤਿੰਨ ਵਜੇ ਦੇ ਨਜ਼ਦੀਕ ਦਾ ਸਮਾਂ ਹੁੰਦਾ ਹੈ ਉਸ ਸਮੇਂ ਉੱਠ ਕੇ ਉਹ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਅਤੇ ਉਸ ਤੋਂ ਬਾਅਦ ਆਪਣਾ ਨਾਮ ਜਪਦੇ ਹਨ ਅਤੇ ਉਸ ਉਹ ਉੱਠ ਕੇ ਇਹ ਸਭ ਕੁਛ ਕਰਕੇ ਆਪਣਾ ਅਭਿਆਸ ਪੂਰਾ ਕਰਦੇ ਹਨ ਅਤੇ ਇਸ ਨਾਲ ਉਹਨਾਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਜੋ ਲੋਕ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕਦੇ ਹਨ ਉਹਨਾਂ ਨੂੰ ਕਈ ਪ੍ਰਕਾਰ ਦੇ ਅਭਿਆਸ ਕਰਨੇ ਪੈਂਦੇ ਹਨ ਅਤੇ ਉਹਨਾਂ ਨੂੰ ਕਈ ਚੀਜ਼ਾਂ ਦੀ ਮਨਾਹੀ ਹੁੰਦੀ ਹੈ ਜਿਵੇਂ ਕਿ ਉਹ ਆਪਣੇ ਕੇਸ ਕਤਲ ਨਹੀਂ ਕਰਾ ਸਕਦੇ ਅਤੇ ਉਸ ਤੋਂ ਇਲਾਵਾ ਆਪਣੇ ਰੋਮਾਂ ਦੀ ਰਕਸ਼ਾ ਕਰਦੇ ਹਨ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਣ ਦਿੰਦੇ ਉਹਨਾਂ ਨੂੰ ਉਹਨਾਂ ਲਈ ਪੰਜ ਕੱਕੇ ਜੋ ਕਿ ਕੜਾ ਕਛਹਿਰਾ ਕਿਰਪਾਨ ਕੰਘਾ ਅਤੇ ਕੇਸ ਹਨ ਉਹ ਰੱਖਣੇ ਬਹੁਤ ਜ਼ਰੂਰੀ ਹਨ ਉਹਨਾਂ ਨੂੰ ਕਛਹਿਰਾ ਅ ਪਹਿਣ ਕੇ ਰੱਖਣ ਦੀ ਪੈ ਪਹਿਨ ਕੇ ਰੱਖਣ ਲਈ ਕਿਹਾ ਗਿਆ ਹੈ ਅਤੇ ਉਹਨਾਂ ਦੇ ਕੰਘਾ ਹਮੇਸ਼ਾਂ ਉਹਨਾਂ ਦੇ ਕੇਸਾਂ ਨਾਲ ਲੱਗਿਆ ਰਹਿਣਾ ਚਾਹੀਦਾ ਹੈ ਅਤੇ ਉਸ ਤੋਂ ਇਲਾਵਾ ਅ ਉਹਨਾਂ ਨੂੰ ਮੀਟ ਆਦਿ ਖਾਣ ਦੀ ਮਨਾਹੀ ਹੈ ਅਤੇ ਉਹਨਾਂ ਨੂੰ ਨਾਮ ਜਪਣ ਅਤੇ ਸਭ ਬਾਕੀ ਸਭ ਚੀਜ਼ਾਂ ਕਰਨ ਨ ਬਾਰੇ ਜ਼ਰੂਰ ਕਰਨਾ ਚਾਹੀਦਾ ਹੈ ਉਸ ਤੋਂ ਇਲਾਵਾ ਮੈਂ ਹਿੰਦੂ ਧਰਮ ਬਾਰੇ ਕੁਛ ਕੁ ਜਾਣਕਾਰੀ ਜਾਣਦਾ ਹਾਂ ਜਿਵੇਂ ਥੋੜ੍ਹੇ ਦਿਨ ਪਹਿਲਾਂ ਨਵਰਾਤਰੇ ਗਏ ਹਨ ਉਸ ਵਿੱਚ ਬਹੁਤ ਸਾਰੇ ਲੋਕ ਹਿ ਧਰਮ ਵਿੱਚ ਪੂਜਾ ਕਰਦੇ ਹਨ ਜਿਵੇਂ ਕਿ ਸਾਡੇ ਸਿੱਖ ਧਰਮ ਵਿੱਚ ਅਸੀਂ ਦੀਪਮਾਲਾ ਕਰਦੇ ਹਨ ਤਾਂ ਉਹ ਆਰਤੀ ਆਦਿ ਕਰਦੇ ਹਨ ਅਤੇ ਉਹ ਆਖਰੀ ਦਿਨ ਦੇ ਵਿੱਚ ਵੀ ਨਵਰਾਤਰੇ ਦੇ ਆਖਰੀ ਦਿਨ ਦੇ ਵਿੱਚ ਵੀ ਪੂਜਾ ਆਦਿ ਕਰਦੇ ਹਨ ਅਤੇ ਉਹਨਾਂ ਦੇ ਲਈ ਵੀ ਇਹ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ